ਪੰਜਾਬ ਦੇ ਵਿੱਚ ਹੈਲਥ ਕੇਅਰ 'ਤੇ ਤੱਕ ਪਹੁੰਚਣ ਲਈ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਕਿ ਜਿਵੇਂ ਐਂਬੂਲੈਂਸ ਵੀ ਜਲਦੀ ਜਲਦੀ ਉਪਲਬਧ ਨਹੀਂ ਹੁੰਦੀ ਪਿੰਡਾਂ ਵਿੱਚ ਖਾਸ ਕਰਕੇ ਸਪੈਸ਼ਲ ਡਾਕਟਰ ਨਹੀਂ ਹੁੰਦੇ ਜਿਸ ਬਿਮਾਰੀ ਦਾ ਕਾਰਨ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਜਿਸ ਤਰ੍ਹਾਂ ਕੋਈ ਵੀ ਸਪੈਸ਼ਲ ਡਾਕਟਰ ਹੋਵੇ ਉਹ ਸਾਨੂੰ ਨਹੀਂ ਮਿਲਦੇ ਹਨ ਜੋ ਕਿ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਸਾਨੂੰ ਬਾਹਰ ਜਾਣਾ ਪੈਂਦਾ ਹੈ ਪੰਜਾਬ ਵਿੱਚ ਇੱਕ ਤਾਂ ਦਵਾਈਆਂ ਵੀ ਬਹੁਤ ਸਰਕਾਰੀ ਹਸਪਤਾਲਾਂ ਵਿੱਚ ਘੱਟ ਉਪਲਬਧ ਹਨ ਜਿਸ ਕਰਕੇ ਸਾਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡਾਂ ਵਿੱਚ ਤਾਂ ਖਾਸ ਕਰਕੇ ਹੋਸਪੀਟਲ ਵੀ ਬਹੁਤ ਘੱਟ ਹਨ ਜਿਹਨਾਂ ਕਰਕੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪੰਜਾਬ ਸ਼ਹਿਰਾਂ ਦੇ ਵਿੱਚ ਵੀ ਬਹੁਤ ਸਰਕਾਰੀ ਹਸਪਤਾਲਾਂ ਵਿੱਚ ਕਈ ਬਿਮਾਰੀਆਂ ਦੇ ਡਾਕਟਰ ਨਹੀਂ ਹੁੰਦੇ ਹਨ ਉਪਲਬਧ ਨਹੀਂ ਹੁੰਦੇ ਜਿਵੇਂ ਕਿ ਹਰਟ ਵਾਲੇ ਡਾਕਟਰ ਹੋ ਗਏ ਜਿਸ ਤਰ੍ਹਾਂ ਕੋਈ ਅੱਖਾਂ ਵਾਲਾ ਹਸਪਤਾਲ ਦੇ ਵਿੱਚ ਵੀ ਨਹੀਂ ਮਿਲਦਾ ਇਸ ਤਰ੍ਹਾਂ ਸਾਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਐਬੂਲੈਂਸ ਵੀ ਜਲਦੀ ਜਲਦੀ ਸਾਡੇ ਕੋਲ ਸੁਵਿਧਾ ਪਹੁੰਚਾਉਣ ਦੀ ਸਾਡੇ ਕੋਲ ਪਹੁੰਚਦੀ ਨਹੀਂ ਅਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਸਹੂਲਤਾਂ ਸਾਨੂੰ ਪ੍ਰਦਾਨ ਕੀਤੀਆਂ ਜਾਣ ਜੋ ਕਿ ਗਰੀਬ ਬੰਦਾ ਇੱਕ ਇਲਾਜ ਕਰਵਾਉਣ ਦੇ ਵਿੱਚ ਸਹਾਇਤਾ ਕਰਨ